ਹੈਲੋ ਹਾਂਜੀ ਅੱਛਾ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਲਏ ਸੀ ਹਮ ਹਮ ਓਕੇ ਅੱਛਾ ਰਾਜੇ ਗੱਲ ਇਹ ਆ ਕਿ ਤੁਸੀਂ ਜਿੰਨਾਂ ਸਬਜੈਕਟਸ ਜਿਹੜੇ ਤੁਸੀਂ ਓਪਸ਼ਨਲ ਲਏ ਹੋਏ ਸੀਗੇ ਉਹਨਾਂ ਵਿੱਚ ਤੁਸੀਂ ਮਾਸਟਰਸ ਕਰ ਸਕਦੇ ਓਂ ਜਾਂ ਕੁਛ ਕ ਸਬਜੈਕਟ ਇਹੋ ਜਿਹੇ ਨੇ ਜਿਹਨਾਂ ਦੇ ਵਿੱਚ ਉਸ ਪਰਟੀਕੂਲਰ ਸਬਜੈਕਟ ਨੂੰ ਮਤਲਬ ਗ੍ਰੈਜੂਏਸ਼ਨ ਦੇ ਵਿੱਚ ਓਪਸ਼ਨਲ ਲਿਆ ਹੋਣਾ ਵੀ ਜ਼ਰੂਰੀ ਨਹੀਂ ਹੈਗਾ ਇੱਕ ਤਾਂ ਤੁਹਾਡੇ ਕੋਲ ਮਾਸਟਰਸ ਦੀ ਓਪਸ਼ਨ ਹੈ ਇਸ ਤੋਂ ਸਿਵਾ ਯੂਨੀਵਰਸਿਟੀ ਦੇ ਵਿੱਚ ਕੁਛ ਸਰਟੀਫਿਕੇਟ ਸਿਕਸ ਮੰਨਥ ਦੇ ਕੋਰਸ ਨੇ ਅਤੇ ਇੱਕ ਵਨ ਈਅਰ ਡਿਪਲੋਮਾ ਦਾ ਵੀ ਓਪਸ਼ਨ ਹੈਗੀ ਆ ਠੀਕ ਹੈ ਇਸ ਤੋਂ ਸਿਵਾ

ਐੱਲ ਐੱਲ ਬੀ ਹਾਂ ਅਗਰ ਤੁਹਾਡਾ ਇੰਟਰਸਟ ਐੱਲ ਐੱਲ ਬੀ ਦੇ ਵਿੱਚ ਹੈਗਾ ਤਾਂ ਤੁਸੀਂ ਉਹ ਵੀ ਕਰ ਸਕਦੇ ਓਂ ਜਾਂ ਅਗਰ ਤੁਸੀਂ ਪਲੱਸ ਟੂ ਤੋਂ ਬਾਅਦ ਕਰਦੇ ਤਾਂ ਫਾਈਵ ਈਅਰ ਦੀ ਡਿਗਰੀ ਸੀਗੀ ਹੁਣ ਤੁਹਾਡੀ ਜੋ ਕਿ ਗਰੈਜੂਏਸ਼ਨ ਹੋ ਚੁੱਕੀ ਹੈ ਤਾਂ ਤੁਹਾਨੂੰ ਇਹ ਤਿੰਨ ਸਾਲ ਹੀ ਲੱਗਣਗੇ ਇਹਦੇ ਵਿੱਚ ਹਾਂ ਹਾਂ ਤੁਸੀਂ ਐੱਲ ਐੱਲ ਬੀ ਵੀ ਕਰ ਸਕਦੇ ਓਂ ਇਨਫੈਕਟ ਬਾਕੀ ਵੀ ਤੁਹਾਡੇ ਕੋਲ ਓਪਸ਼ਨ ਅਗਰ ਤੁਸੀਂ ਮਾਸਟਰਸ ਕਰਦੇ ਓਂ ਤਾਂ ਉਹਦੇ ਵਿੱਚ ਜਦੋਂ ਤੁਸੀਂ ਫੋਮ ਭਰੋਗੇ ਤਾਂ ਤੁਹਾਡੇ ਕੋਲ ਤਿੰਨ ਓਪਸ਼ਨਸ ਅਵੇਲੇਬਲ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਤੁਸੀਂ ਫਸਟ ਪ੍ਰੈਫਰੈਂਸ ਸੈਕਿੰਡ ਅਤੇ ਥਰਡ ਭਰ ਸਕਦੇ ਹੋ ਤੁਸੀਂ ਇਹਨਾਂ ਦੀ ਐਡਮਿਸ਼ਨ ਫੀਸ ਸਟਕਚਰ ਐਵਰੀਥਿੰਗ ਯੂਨੀਵਰਸਿਟੀ ਵੈਬਸਾਈਟ 'ਤੇ ਅਵੇਲੇਬਲ ਹੈਗਾ ਤੁਸੀਂ ਉੱਥੋਂ ਚੈੱਕ ਕਰ ਸਕਦੇ ਓਂ ਓਕੇ ਓਕੇ ਹਾਂਜੀ ਓਕੇ ਓਕੇ